ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੇ ਰਹਿਣ ਵਾਲੀ ਹਾਂ ਅੱਜ ਅਸੀਂ ਕਿਸੇ ਗਾਇਕ ਦੇ ਬਾਰੇ ਗੱਲ ਕਰਦੇ ਹਾਂ ਕਿ ਅਸੀਂ ਕਿਸੇ ਗਾਇਕ ਨੂੰ ਲਾਈਵ ਸੁਣਿਆ ਹੈ ਕਿ ਨਹੀਂ ਹਾਂ ਅਸੀਂ ਇੱਕ ਗਾਇਕ ਨੂੰ ਲਾਈਵ ਸੁਣਿਆ ਸੀ ਸਾਡੇ ਘਰ ਦੇ ਬਾਹਰ ਇੱਕ ਜਗਰਾਤਾ ਹੋਇਆ ਸੀ ਉੱਥੇ ਮਾਸਟਰ ਸਲੀਮ ਜੀ ਆਏ ਹੋਏ ਸੀ ਅਤੇ ਉਹਨਾਂ ਨੇ ਇੰਨੀਆਂ ਇੰਨੀਆਂ ਚੰਗੀਆਂ ਭੇਟਾਂ ਗਾਈਆ ਕਿ ਉਹਨਾਂ ਨੇ ਸਾਨੂੰ ਇੰਨਾ ਆਨੰਦ ਆਇਆ ਸੁਣ ਕੇ ਕਿ ਸਾਡਾ ਉਹਨਾਂ ਨੂੰ ਵਾਰ ਵਾਰ ਸੁਣਨ ਦਾ ਬਹੁਤ ਦਿਲ ਕਰ ਰਿਹਾ ਸੀ ਅਤੇ ਅਸੀਂ ਮਾਸਟਰ ਸਲੀਮ ਦੀਆਂ ਭੇਟਾਂ ਸੁਣ ਸਾਰੀ ਰਾਤ ਅਸੀਂ ਇਸ ਤਰ੍ਹਾਂ ਦੋ ਘੰਟੇ ਵੀ ਨਹੀਂ ਜਾਗ ਸਕਦੇ ਸਾਨੂੰ ਇੰਨੀ ਨੀਂਦ ਆਉਂਦੀ ਹੈ ਕਿ ਸਾਡੇ ਕੋਲੋਂ ਜਾਗਣਾ ਬੜਾ ਔਖਾ ਹੋ ਜਾਂਦਾ ਹੈ ਜਦੋਂ ਮਾਸਟਰ ਸਲੀਮ ਜੀ ਨੇ ਭੇਟਾਂ ਸ਼ੁਰੂ ਕੀਤੀਆਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਰਾਤ ਕਿਸ ਤਰ੍ਹਾਂ ਨਿਕਲ ਗਈ ਅਸੀਂ ਪੂਰੀ ਰਾਤ ਬਹਿ ਕੇ ਉਹਨਾਂ ਦੀਆਂ ਭੇਟਾਂ ਹੀ ਸੁਣਦੇ ਰਹੇ ਮਾਸਟਰ ਸਲੀਮ ਜੀ ਨੇ ਇੰਨੀਆਂ ਸੋਹਣੀਆਂ ਸੋਹਣੀਆਂ ਭੇਟਾਂ ਇੰਨੇ ਸੋਹਣੇ ਸੋਹਣੇ ਸਾਨੂੰ ਭਜਨ ਸੁਣਾਏ ਕਿ ਸਾਨੂੰ ਕੋਈ ਪਤਾ ਨਹੀਂ ਚੱਲਿਆ ਉਹਨਾਂ ਨੇ ਕੁਛ ਭਜਨ ਸਾਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਸੁਣਾਏ ਕੁਛ ਰਾਮ ਜੀ ਦੇ ਸੁਣਾਏ ਅਤੇ ਕੁਛ ਮਾਤਾ ਜੀ ਦੀਆਂ ਭੇਟਾਂ ਗਾਈਆਂ ਉਸ ਤੋਂ ਬਾਅਦ ਮਾਸਟਰ ਸਲੀਮ ਜੀ ਨੇ ਸਾਨੂੰ ਇਹ ਇਹ ਦੱਸਿਆ ਮਾਤਾ ਮਾਤਾ ਰਾਣੀ ਜੀ ਕਹਾਣੀ ਵੀ ਸੁਣਾਈ ਕਿ ਮਾਂ ਜਿਹੜੀ ਮਾਤਾ ਹੈ ਉਹ ਕਿਸ ਤਰ੍ਹਾਂ ਪ੍ਰਗਟ ਹੋਈ ਸੀ ਸ਼ਿਵ ਸ਼ਕਤੀ ਕਿਸ ਤਰ੍ਹਾਂ ਪ੍ਰਗਟ ਹੋਈ ਸੀ ਜਦੋਂ ਅਸੀਂ ਮਾਸਟਰ ਸਲੀਮ ਜੀ ਦੀਆਂ ਇਹ ਗੱਲਾਂ ਸੁਣਦੇ ਸੀ ਤਾਂ ਸਾਨੂੰ ਬਿਲਕੁਲ ਵੀ ਨੀਂਦ ਨਹੀਂ ਸੀ ਆਉਂਦੀ ਅਤੇ ਅਸੀਂ ਮਾਸਟਰ ਸਲੀਮ ਜੀ ਨੂੰ ਸੁਣਨਾ ਬਹੁਤ ਹੀ ਪਸੰਦ ਕਰਦੇ ਹਾਂ ਤਾਂ ਕਿ ਮਾਸਟਰ ਅਸੀਂ ਕਹਿੰਦੇ ਹਾਂ ਕਿ ਸਾਡੇ ਵਾਰ ਵਾਰ ਇੱਥੇ ਜਗਰਾਤਾ ਹੋਵੇ ਅਤੇ ਅਸੀਂ ਮਾਸਟਰ ਸਲੀਮ ਜੀ ਨੂੰ ਫਿਰ ਤੋਂ ਸੁਣੀਏ ਸਾਨੂੰ ਜਦੋਂ ਵੀ ਕਦੇ ਕਿਤੇ ਪਤਾ ਲੱਗਦਾ ਹੈ ਕਿ ਉੱਥੇ ਅੱਜ ਮਾਸਟਰ ਸਲੀਮ ਜੀ ਨੇ ਆਉਣਾ ਹੈ ਤਾਂ ਸਾਡਾ ਮਨ ਇੰਨਾ ਕਰ ਹੋ ਜਾਂਦਾ ਕਿ ਅਸੀਂ ਹੁਣੇ ਹੀ ਉੱਥੇ ਜਾਈਏ ਅਤੇ ਮਾਸਟਰ ਸਲੀਮ ਜੀ ਨੂੰ ਸੁਣ ਕੇ ਆਈਏ ਕਦੇ ਕਦੇ ਤਾਂ ਅਸੀਂ ਆਪਣਾ ਟਾਈਮ ਕੱਢ ਕੇ ਚੱਲ ਹੀ ਜਾਂਦੇ ਹਾਂ ਪਰ ਕਦੇ ਕਦੇ ਅਸੀਂ ਰਹਿ ਜਾਂਦੇ ਹਾਂ ਜਦੋਂ ਅਸੀਂ ਨਹੀਂ ਜਾ ਪਾਉਂਦੇ ਤਾਂ ਸਾਨੂੰ ਮਾਸਟਰ ਸਲੀਮ ਜੀ ਦੀ ਬਹੁਤ ਯਾਦ ਆਉਂਦੀ ਹੈ ਅਤੇ ਅਸੀਂ ਕਹਿੰਦੇ ਹਾਂ ਕਿ ਮਾਸਟਰ ਸਲੀਮ ਜੀ ਕਿਤੇ ਸਾਡੇ ਇੱਥੇ ਕੁਛ ਗਾਉਣ ਲਈ ਆ ਜਾਣ ਤਾਂ ਅਸੀਂ ਇਹ ਸੁਣ ਲਈਏ ਸਾਨੂੰ ਮਾਸਟਰ ਸਲੀਮ ਜੀ ਦੇ ਗਾਣੇ ਜਾਂ ਭਜਨ ਜਾਂ ਭੇਟਾ ਬਹੁਤ ਹੀ ਚੰਗੀਆਂ ਲੱਗਦੀਆ ਹਨ